ਬਾਈਕਿੰਗ ਕਮਿਊਨਿਟੀ ਵਿੱਚ ਸ਼ਾਮਿਲ ਹੋਣ ਬਹੁਤ ਸੌਖਾ ਹੈ ਤੁਸੀਂ ਇੱਕ ਲੰਬੇ ਸਫ਼ਰ 'ਤੇ ਚਲ ਜਾਓ ਬਾਈਕ ਦੇ ਦੌਰਾਨ ਜਿਸ ਵਿੱਚ ਤੁਹਾਨੂੰ ਬਹੁਤ ਸਾਰੇ ਬਈਕਰ ਮਿਲਣਗੇ ਅਤੇ ਉਹਨਾਂ ਨਾਲ ਸ਼ਾਮਲ ਹੋਣ ਲਈ ਤੁਹਾਨੂੰ ਕੋਈ ਜ਼ਿਆਦਾ ਦਿੱਕਤ ਨਹੀਂ ਆਊਗੀ ਉਹਨਾਂ ਨਾਲ ਗੱਲਬਾਤ ਕਰੋ ਤੁਹਾਡੀ ਬਾਈਕ ਬਾਰੇ ਉਹਨਾਂ ਨੂੰ ਦੱਸੋ ਅਤੇ ਉਹਨਾਂ ਅੱਗੇ ਥੋੜ੍ਹੇ ਸਟੰਟ ਵਗੈਰਾ ਕਰੋ ਜਿਸ ਨਾਲ ਤੁਹਾਡੇ ਨਾਲ ਗੱਲਬਾਤ ਕਰਨ ਤੁਹਾਨੂੰ ਪੁੱਛ ਕਰਨ ਵੀ ਹਾਂ ਕਿੱਦਾਂ ਕਿਵੇਂ ਕਰਿਆ ਮੈਨੂੰ ਸਿਖਾਓ ਯੇ ਕਰੋ ਵੋ ਕਰੋ ਤਾਂ ਜਿਸ ਨਾਲ ਤੁਹਾਨੂੰ ਬਾਈਕਰ ਨਾਲ ਗੱਲਬਾਤ ਕਰਨ ਵਿੱਚ ਸੌਖਾ ਹੋਵੇਗਾ ਅਤੇ ਜਿਸ ਨਾਲ ਉਹ ਤੁਹਾਡੇ ਕਣੀ ਅਟਰੈਕਟ ਹੋਣਗੇ ਵੀ ਤੁਸੀਂ ਸਟੰਟ ਵਗੈਰਾ ਕਰੋਂਗੇ ਅਤੇ ਜਿਸ ਨਾਲ ਵੀ ਤੁਸੀਂ ਲੰਬੇ ਸਫ਼ਰ 'ਤੇ ਜਾਓਂਗੇ ਤਾਂ ਤੁਹਾਡੇ ਨਾਲ ਜੋ ਹੋਰ ਬਾਈਕਰ ਵੀ ਹੋਣਗੇ ਤਾਂ ਤੁਹਾਨੂੰ ਸਫ਼ਰ ਵਿੱਚ ਕੋਈ ਵੀ ਦਿੱਕਤ ਨਹੀਂ ਆਵੇਗੀ ਜਿਸ ਕਾ ਜਿਸ ਨਾਲ ਤੁਹਾਡਾ ਸਫ਼ਰ ਵੀ ਬਹੁਤ ਵਧੀਆ ਤਰੀਕੇ ਨਾਲ ਨਿਕਲੂਗਾ ਅਤੇ ਤੁਸੀਂ ਦੂਜੇ ਨੂੰ ਆਪ ਨਾਲ ਆਪਣੇ ਜੋ ਸਟੰਟ ਵਗੈਰਾ ਸੇਫਲੀ ਕਰੋ ਅਤੇ ਦੈਨ ਦੂਜਾ ਬੰਦਾ ਵੀ ਤੁਹਾਨੂੰ ਪੁੱਛੇ ਕਿੱਦਾਂ ਕਰਿਆ ਕਿਵੇਂ ਕਰਿਆ ਤਾਂ ਦੈਨ ਓਨੀ ਨੌਲੇਜ ਰੱਖੋ ਤੁਸੀਂ ਉਹਨੂੰ ਦੱਸ ਸਕੋ ਜਿਸ ਨਾਲ ਬਾਈਕਿੰਗ ਜਿਹੜੀ ਕਮਿਊਨਿਟੀ ਹੈ ਉਸ ਵਿੱਚ ਤੁਸੀਂ ਸ਼ਾਮਿਲ ਹੋ ਸਕਦੇ ਹੋ ਸਵਾਰੀਆਂ ਉਹਨਾਂ ਨਾਲ ਗੱਲਬਾਤ ਵੀ ਤੁਸੀਂ ਆਰਾਮ ਨਾਲ ਕਰ ਸਕਦੇ ਹੋ ਅਤੇ ਤੁਸੀਂ ਫਿਰ ਬਾਅਦ 'ਚ ਪੁੱਛ ਸਕਦੇ ਹੋ ਵੀ ਹਾਂ ਤੁਸੀਂ ਕਿੱਥੇ ਜਾ ਰਹੇ ਹੋ ਤੁਸੀਂ ਆਪਦੇ ਬਾਰੇ ਦੱਸੋ ਵੀ ਮੈਂ ਇੱਥੋਂ ਚੱਲਿਆ ਇੱਥੋਂ ਸਫ਼ਰ ਕੀਤਾ ਮੇਰੇ ਕੋਲ ਆਹ ਬਾਇਕ ਆ ਤੁਹਾਡੇ ਕੋਲ ਕਿਹੜੀ ਹੈ ਇਹਦੇ ਬਾਰੇ ਖ਼ਾਸੀਅਤ ਕਿਆ ਹੈ ਇਹ ਖ਼ਾਸੀਅਤ ਕਿਆ ਹੈ ਦੈਨ ਬਾਇਕ ਤੁਸੀਂ ਸ਼ੇਅਰ ਕਰੋਂਗੇ ਅਤੇ ਦੈਨ ਤੁਸੀਂ ਜਿਹੜੇ ਕਸਟਮਰ ਨਾਲ ਜੋ ਵੀ ਉਸ ਨਾਲ ਗੱਲਬਾਤ ਕਰ ਸਕਦੇ ਸਵਾਰੀਆਂ ਨਾਲ ਤਾਂ ਜਿਸ ਵਿੱਚ ਤੁਹਾਨੂੰ ਕੋਈ ਜ਼ਿਆਦਾ ਦਿੱਕਤ ਨਹੀਂ ਆਊਗੀ ਗੱਲਬਾਤ ਕਰਨ ਦੇ ਵਿੱਚ